ਸਤਿ ਸ਼੍ਰੀ ਅਕਾਲ ਸਾਰੇ ਮੇਰੇ ਭਰਾਵਾਂ ਅਤੇ ਭੈਣਾਂ ਨੂੰ ਮੇਰਾ ਨਾਮ ਮਾਨਵ ਪਠਾਣੀਆ ਹੈ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਗਰ ਮੈਂ ਕੱਪੜੇ ਧੋਣ ਦੀ ਗੱਲ ਕਰਾਂ ਤਾਂ ਮੈਂ ਕੱਪੜੇ ਧੋਣ ਲਈ ਆਪਣੀ ਵੋਸ਼ਿੰਗ ਮਸ਼ੀਨ ਦੀ ਵਰਤੋਂ ਕਰਦਾ ਹਾਂ ਮੈਂ ਆਪਣੇ ਰੋਜ਼ਾਨਾ ਕੱਪੜੇ ਅਗਰ ਮੈਂ ਆਪਣੇ ਦਿਨਚਰਿਆ ਦੀ ਗੱਲ ਕਰਾਂ ਤਾਂ ਕੋਲਜ ਮੈਨੂੰ ਜਾਣਾ ਹੁੰਦਾ ਹੈ ਜਿਸ ਕਰਕੇ ਮੈਨੂੰ ਇੰਨਾ ਟਾਈਮ ਨਹੀਂ ਲੱਗਦਾ ਇਸ ਲਈ ਮੈਂ ਐਤਵਾਰ ਦਾ ਦਿਨ ਰੱਖਿਆ ਹੋਇਆ ਹੈ ਜਿਸ ਦਿਨ ਮੈਂ ਸਾਰੇ ਕੱਪੜੇ ਧੌਂਦਾ ਹਾਂ ਮੈਂ ਆਪਣੇ ਕੱਪੜੇ ਵਾਸ਼ਿੰਗ ਮਸ਼ੀਨ ਦੁਆਰਾ ਧੌਂਦਾ ਹਾਂ ਅਤੇ ਅਗਰ ਮੈਂ ਉਹਨਾਂ ਨੂੰ ਸੁਕਾਉਣ ਦੀ ਗੱਲ ਕਰਾਂ ਤਾਂ ਮੈਂ ਡਰਾਈਅਰ ਦਾ ਯੂਜ ਕਰ ਲੈਂਦਾ ਹਾਂ ਪਰ ਕਈ ਵਾਰ ਜਿੱਦਾਂ ਕਿ ਬਹੁਤ ਅੱਛੀ ਧੁੱਪ ਨਿਕਲੀ ਹੋਵੇ ਤਾਂ ਮੈਂ ਆਪਣੇ ਕੱਪੜੇ ਧੁੱਪ ਵਿੱਚ ਸੁੱਕਣੇ ਪਾ ਦਿੰਦਾ ਹਾਂ ਅਗਰ ਮੈਂ ਕਈ ਵਾਰ ਕਿਤੇ ਜਾਣਾ ਹੋਵੇ ਜਾਂ ਕੁਛ ਕੰਮ ਪੈ ਜਾਵੇ ਤਾਂ ਮੈਂ ਆਪਣੇ ਕੱਪੜੇ ਧੋਬੀ ਘਾਟ ਨੂੰ ਭੇਜ ਦਿੰਦਾ ਹਾਂ ਸਾਰੇ ਇਕੱਠੇ ਕੱਪੜੇ ਜੋ ਕਿ ਉਹ ਧੋ ਦਿੰਦੇ ਹਨ ਅਤੇ ਫਿਰ ਵਾਪਸ ਕਰ ਦਿੰਦੇ ਹਨ ਧੰਨਵਾਦ